ਖੇਡਾਂ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ ਜੋ ਕਿ ਸਾਡੇ ਸਰੀਰ ਲਈ ਕਿਸੇ ਵੀ ਬਿਮਾਰੀ ਨੂੰ ਜਾਂ ਤੰਦਰੁਸਤ ਰਹਿਣ ਲਈ ਸਾਨੂੰ ਖੇਡਾਂ ਖੇਡਣੀਆਂ ਪੈਂਦੀਆਂ ਨੇ ਜਿਵੇਂ ਕਿ ਲੋਕ ਸਵੇਰੇ ਸੈਰ ਕਰਦੇ ਹਨ ਅਤੇ ਗਰਾਊਂਡ ਲਾਉਂਦੇ ਹਨ ਗਰਾਊਂਡ ਦੇ ਵਿੱਚ ਜਾ ਕੇ ਯੋਗਾ ਕਰਦੇ ਹਨ ਅਤੇ ਦੌੜਦੇ ਭੱਜਦੇ ਹਨ ਅਤੇ ਖੇਡਾਂ ਖੇਡਦੇ ਨੇ ਇਸ ਲਈ ਖੇਡਾਂ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ ਅਤੇ ਸਰੀਰ ਖੇਡਾਂ ਖੇਡਣ ਨਾਲ ਤੰਦਰੁਸਤ ਰਹਿੰਦਾ ਹੈ ਅਤੇ ਜੋ ਵੀ ਬੱਚੇ ਚੰਗੀ ਖੇਡ ਖਡ ਖੇਡਦੇ ਹਨ ਉਹਨਾਂ ਨੂੰ ਚੰਗੀਆਂ ਸਰਕਾਰਾਂ ਵੱਲੋਂ ਚੰਗੀਆਂ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਕ੍ਰਿਕਿਟ ਹੋ ਗਈ ਕਬੱਡੀ ਹੋ ਗਈ ਹੋਰ ਕਈ ਗੇਮਾਂ ਨੇ ਜਿਹਨਾਂ ਵਿੱਚ ਬੱਚੇ ਭਾਗ ਲੈਂਦੇ ਹਨ ਅਤੇ ਫਸਟ ਆਉਂਦੇ ਹਨ ਜ਼ਿਲ੍ਹਾ ਲੈਵਲ 'ਤੇ ਪੰਜਾਬ ਲੈਵਲ 'ਤੇ ਉਹਦਾ ਸੈਂਟਰਲ ਸੈਂਟਰ ਲੈਵਲ 'ਤੇ ਖੇਡਦੇ ਹਨ ਉਹਨਾਂ ਨੂੰ ਨੌਕਰੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ